ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਸ਼ੁਰੂ ਤੋਂ ਹੀ ਮੋਟਰਸਾਈਕਲ ਦੀ ਸਵਾਰ ਕਰਨਾ ਬਹੁਤ ਪਸੰਦ ਕਰਦਾ ਹਾਂ ਮੈਨੂੰ ਬਚਪਨ ਤੋਂ ਹੀ ਬਾਈਕਾਂ ਦਾ ਬਹੁਤ ਸ਼ੌਂਕ ਹੈ ਜਦ ਮੈਂ ਪੰਜ ਕੁ ਸਾਲਾਂ ਦਾ ਸੀ ਤਾਂ ਮੈਨੂੰ ਮੇਰੇ ਪਿਤਾ ਨੇ ਇੱਕ ਬੈਟਰੀ ਵਾਲੀ ਬਾਈਕ ਲੈ ਕੇ ਦਿੱਤੀ ਸੀ ਜਿਸਦੀ ਕੀਮਤ ਪੰਜ ਹਜ਼ਾਰ ਰੁਪਏ ਸੀ ਦੋ ਹਜ਼ਾਰ ਪੰਜ ਦੇ ਵਿੱਚ ਉਹ ਬਾਈਕ ਤੋਂ ਮੈਨੂੰ ਐਸਾ ਝਸ ਪੈ ਗਿਆ ਬਾਈਕ ਨਾਲ ਐਸਾ ਪਿਆਰ ਪੈ ਗਿਆ ਕਿ ਮੈਂ ਅੱਜ ਤੱਕ ਬਾਈਕਾਂ ਨੂੰ ਬਹੁਤ ਪਸੰਦ ਕਰਦਾ ਹਾਂ ਮੈਂ ਕੁਛ ਦੋ ਤਿੰਨ ਮਹੀਨੇ ਪਹਿਲਾਂ ਹੀ ਲੇਹ ਲਦਾਖ ਦੀ ਰਾਈਡ ਕਰਕੇ ਆਇਆ ਹਾਂ ਸਫ਼ਰ ਮੈਂ ਬਹੁਤ ਵਧੀਆ ਤਰੀਕੇ ਨਾਲ ਇੰਜੋਏ ਕੀਤਾ ਅਤੇ ਕਦੇ ਵੀ ਅੱਜ ਤੱਕ ਮੇਰੇ ਮੋਢੇ ਜਾਂ ਦਰਦ ਦਰਦ ਮੋਢੇ ਦੀਆਂ ਪਿੱਠ ਵਿੱਚ ਕਦੇ ਵੀ ਦਰਦ ਨਹੀਂ ਹੋਈ ਕਿਉਂਕਿ ਮੈਂ ਉਸ ਚੀਜ਼ ਨੂੰ ਇੰਜੋਏ ਕਰਦਾ ਹਾਂ ਕਦੇ ਵੀ ਮੈਂ ਟੈਂਸ਼ਨ ਨਹੀਂ ਲੈਂਦਾ ਕਿ ਮੈਂ ਬਾਈਕ ਚਲਾ ਰਿਹਾ ਹਾਂ ਮੈਂ ਆਪਣੇ ਸਫ਼ਰ ਨੂੰ ਇੰਜੋਏ ਕਰਦਾ ਹਾਂ ਬਾਈਕ 'ਤੇ ਜਦੋਂ ਮੈਂ ਜਾਂਦਾ ਹਾਂ ਤਾਂ ਮੇਰੀ ਆਦਤ ਹੈ ਕਿ ਮੈਂ ਦਸ ਵਜੇ ਬਾਈਕ ਸਟਾਰਟ ਕਰਨੀ ਹੈ ਚਲਾਉਣੀ ਅਤੇ ਸੱਤ ਵਜੇ ਮੈਂ ਜਿੱਥੇ ਵੀ ਮੈਂ ਹੋਵਾਂ ਮੈਂ ਉੱਥੇ ਆਪਣਾ ਹੋਟਲ ਲੈ ਕੇ ਉੱਥੇ ਰਹਿ ਲੈਣਾ ਆ ਹੋਟਲ ਦੇ ਵਿੱਚ ਜਿੰਮ ਹੁੰਦੇ ਆ ਅਤੇ ਨੌ ਵਜੇ ਮੈਂ ਆਪਣਾ ਜਿੰਮ ਕਰਨਾ ਨੌ ਤੋਂ ਦਸ ਮੈਂ ਜਿੰਮ ਕਰਨਾ ਜਿਹਦੇ ਨਾਲ ਕਿ ਮੈਂ ਟਰੈਵਲਿੰਗ ਦੇ ਨਾਲ ਨਾਲ ਸਿਹਤਮੰਦ ਵੀ ਰਹਿ ਸਕਦਾ ਹਾਂ ਅਤੇ ਮੈਨੂੰ ਹੋਟਲਾਂ ਦੇ ਖਾਣੇ ਨਾਲੋਂ ਜਿਹੜੇ ਰੋਡ ਸਾਈਡ ਦੇ ਉੱਪਰ ਖਾਣਾ ਮਿਲਦਾ ਹੈ ਮੈਨੂੰ ਉਹ ਵੱਖਰੇ ਵੱਖਰੇ ਸ਼ਹਿਰਾਂ ਦਾ ਖਾਣਾ ਜ਼ਿਆਦਾ ਪਸੰਦ ਹੁੰਦਾ ਹੈ ਕਿਉਂਕਿ ਟਰੈਵਲ ਕਰਨ ਦਾ ਮਜ਼ਾ ਫਿਰ ਹੀ ਹੈ ਅਗਰ ਆਪਾਂ ਉਹਨਾਂ ਚੀਜ਼ਾਂ ਨੂੰ ਐਕਸਪੀਰੀਅੰਸ ਕਰਦੇ ਹਾਂ ਸੋ ਇਸੇ ਕਰਕੇ ਮੈਨੂੰ ਬਾਈਕ ਰਾਈਡਿੰਗ ਬਹੁਤ ਪਸੰਦ ਹੈ